ਖਾਣਾ ਪਕਾਉਣ ਵੇਲੇ ਅਸੀਂ ਸਟੀਲ ਪਿੱਤਲ ਮਿੱਟੀ ਦੇ ਭਾਂਡੇ ਵਰਤਦੇ ਹਾਂ ਬਦਲਦੇ ਯੁੱਗ ਨਾਲ ਘਰਾਂ ਵਿੱਚੋਂ ਪਿੱਤਲ ਮਿੱਟੀ ਦੇ ਭਾਂਡੇ ਖਤਮ ਹੋ ਗਏ ਹਨ ਸਿਰਫ ਸਟੀਲ ਪਲਾਸਟਿਕ ਜਾਂ ਸਿਰਾਮਿਕ ਜ਼ਿਆਦਾ ਵਰਤੋਂ ਵਿੱਚ ਆਉਣ ਲੱਗ ਪਿਆ ਹੈ ਪਰ ਜੇ ਮੇੈਂ ਆਪਣੀ ਗੱਲ ਕਰਾਂ ਤਾਂ ਮੈਂ ਜ਼ਿਆਦਾਤਰ ਖਾਣਾ ਪਿੱਤਲ ਦੇ ਭਾਂਡੇ ਵਿੱਚ ਹੀ ਪਾ ਬਣਾਉਣਾ ਪਸੰਦ ਕਰਦੀ ਹਾਂ ਕਿਉਂਕਿ ਪਿੱਤਲ ਦੇ ਭਾਂਡੇ ਵਿੱਚ ਖਾਣਾ ਬਣਾਉਣ ਨਾਲ ਸਾਡੇ ਜਿਸ ਤਰ੍ਹਾਂ ਕਿ ਮੈਂ ਦਾਦੀਆਂ ਤੋਂ ਦਾਦੀ ਤੋਂ ਆਪਣੇ ਨਾਨੀ ਤੋਂ ਸੁਣਿਆ ਹੈ ਕਿ ਇਨ੍ਹਾਂ ਵਿੱਚ ਖਾਣਾ ਬਣਾਉਣ ਨਾਲ ਖਾਣਾ ਖਾਣ ਵਾਲੇ ਤੰਦਰੁਸਤ ਰਹਿੰਦੇ ਹਨ ਬਹੁਤ ਸਾਰੀ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਬਹੁਤ ਸਾਰੀਆਂ ਬਿਮਾਰੀਆਂ ਹੋ ਗਈਆਂ ਹਨ ਜਿਹੜੀਆਂ ਕਿ ਜਦੋਂ ਅਸੀਂ ਜੇ ਅਸੀਂ ਪਹਿਲੇ ਟਾਇਮ ਦੀ ਗੱਲ ਕਰੀਏ ਤਾਂ ਇਹ ਬਿਮਾਰੀਆਂ ਦਾ ਨਹੀਂ ਹੁੰਦੀਆਂ ਬਿਮਾਰੀਆਂ ਨਹੀਂ ਹੁੰਦੀਆਂ ਸੀਗੀਆਂ ਸਾਡਾ ਸਾਡੀ ਬਿਮਾਰੀਆਂ ਦਾ ਮੇਨ ਕਾਰਨ ਸਾਡਾ ਖਾਣ ਪਾਣ ਖਾਣ ਪੀਣ ਹੀ ਹੈ ਜਿ ਜਿਸ ਤਰ੍ਹਾਂ ਦਾ ਸਾਡਾ ਖਾਣ ਪੀਣ ਹੋਏਗਾ ਸਾਡੀ ਬੋਡੀ 'ਤੇ ਉਸ ਤਰ੍ਹਾਂ ਦਾ ਹੀ ਪ੍ਰਭਾਵ ਪਏਗਾ ਉਸ ਓਹਦਾ ਉਸ ਚੀਜ਼ ਦਾ ਅਤੇ ਜੇ ਅਸੀਂ ਅੱਜ ਵੀ ਉਨ੍ਹਾਂ ਭਾਂਡਿਆ ਵਿੱਚ ਹੀ ਬਣਾਉਣਾ ਸ਼ੁਰੂ ਕਰ ਦਈਏ ਤਾਂ ਸ਼ਾਇਦ ਸਾਡੀਆਂ ਨਾਇਨਟੀ ਪ੍ਰਸੈਂਟ ਬਿਮਾਰੀਆਂ ਨ ਜਾਂ ਕਹਿ ਇੱਦਾਂ ਕਹਿ ਲਉ ਕਿ ਨੱਬੇ ਪ੍ਰਸੈਂਟ ਬਿਮਾਰੀਆਂ ਸਾਡੀਆਂ ਖਤਮ ਹੋ ਜਾਣਗੀਆਂ ਅਸੀਂ ਉਹਨਾਂ ਬਿਮਾਰੀਆਂ ਤੋਂ ਮੁਕਤ ਹੋ ਜਾਵਾਂਗੇ